ਸਤਿ ਸ਼੍ਰੀ ਅਕਾਲ ਜੀ ਆਪ ਜੀ ਭਰਾਵਾਂ ਦੇ ਢਾਬੇ ਤੋਂ ਬੋਲ ਰਹੇ ਜੀ ਹਾਂਜੀ ਮੈਂ ਨਵਜੋਤ ਸਿੰਘ ਮੈਂ ਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਇਆ ਸੀਗਾ ਅਤੇ ਮੌਸਮ ਦੀ ਤਬਦੀਲੀ ਕਰਕੇ ਮੌਸਮ ਖਰਾਬ ਹੋਣ ਕਰਕੇ ਮੈਂ ਅਚਾਨਕ ਰਸਤੇ ਦੇ ਵਿੱਚ ਰੁਕ ਗਿਆ ਅਤੇ ਜੇਕਰ ਆਪ ਜੀ ਨੂੰ ਮੈਂ ਆਡਰ ਕਰਾਂ ਤਾਂ ਤੁਸੀਂ ਭੋਜਨ ਦੀ ਉਪਲਬਧਤਾ ਕਰਾ ਸਕਦੇ ਹੋ ਮੇਰੇ ਲਈ ਕਿਉਂਕਿ ਵੀ ਭਾਰੀ ਬਾਰਿਸ਼ ਆ ਮੀਂਹ ਬਹੁਤ ਆ ਅਤੇ ਮੈਨੂੰ ਲੱਗਦਾ ਕਿ ਬਹੁਤ ਔਖਾ ਅਤੇ ਜੇ ਤੁਹਾਡੇ ਕੋਲ ਹੈ ਉਪਲਬਧਤਾ ਤੁਸੀਂ ਭੋਜਨ ਪਹੁੰਚਾ ਸਕਦੇ ਹੋ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਅਤੇ ਕਿਉਂਕਿ ਮੁਸ਼ਕਿਲ ਹੈ ਮੌਸਮ ਬਹੁਤ ਖਰਾਬ ਆ ਜਿਹਦੇ ਕਰਕੇ ਮੇਰੀ ਲੋੜ ਵੀ ਆ ਕੀ ਵੀ ਮੈਨੂੰ ਭੋਜਨ ਪਹੁੰਚਾਇਆ ਜਾ ਸਕੇ ਮੈਂ ਇਸੇ ਲਈ ਆਪ ਜੀ ਤੋਂ ਪੁੱਛ ਰਿਹਾਂ ਕਿ ਕੀ ਇਹ ਮੌਸਮ ਕਰਕੇ ਤੁਹਾਨੂੰ ਤਾਂ ਕੋਈ ਮੁਸ਼ਕਿਲ ਤਾਂ ਨਹੀਂ ਤੁਹਾਡਾ ਜਿਹੜਾ ਵੀ ਕੋਈ ਡਿਲੀਵਰੀ ਬੋਆਏ ਆਵੇਗਾ ਉਹਨੂੰ ਵੀ ਮੁਸ਼ਕਿਲ ਹੋ ਸਕਦੀ ਆ ਪਰ ਰਿਕੁਐਸਟ ਹੈ ਕਿ ਵੀ ਜੇ ਤੁਸੀਂ ਕਰ ਸਕਦੇ ਹੋ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਅਤੇ ਮੈਂ ਥੋੜ੍ਹਾ ਅਣਜਾਣ ਸ਼ਹਿਰ ਦੇ ਵਿੱਚ ਹਾਂ ਅਤੇ ਇੱਥੋਂ ਤਕਰੀਬਨ ਕਾਫੀ ਦੂਰ ਤਾਂ ਗੁਰਦੁਆਰਾ ਸਾਹਿਬ ਹੈ ਜੇਕਰ ਉੱਥੇ ਜਾ ਸਕਦਾ ਹੁੰਦਾ ਤਾਂ ਫਿਰ ਮੈਨੂੰ ਲੋੜ ਹੀ ਨਹੀਂ ਸੀ ਪੈਣੀ ਪਰ ਕਿਸੇ ਕਾਰਨ ਕਰਕੇ ਮੈਂ ਉੱਥੋਂ ਤੱਕ ਵੀ ਨਹੀਂ ਜਾ ਸਕਦਾ ਇਸ ਕਰਕੇ ਮੈਂ ਆਪ ਜੀ ਦੇ ਨਾਲ ਸੰਪਰਕ ਕਰ ਰਿਹਾਂ ਕਿਰਪਾ ਕਰਕੇ ਆਪ ਜੀ ਇਹ ਭੋਜਨ ਦੀ ਜਿਹੜੀ ਡਿਲੀਵਰੀ ਆ ਜਿਹੜੀ ਮੈਂ ਆਪ ਜੀ ਨੂੰ ਭੇਜ ਦੇਵਾਂਗਾ ਆਪ ਜੀ ਪੋਸੀਬਿਲਟੀ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਵਾ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ